ਐਸ਼ਵਰਿਆ ਰਾਏ ਅਮਿਤਾਬ ਬੱਚਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਅਮਿਰ ਖਾਨ ਸਲਮਾਨ ਖਾਨ ਸ਼ਾਹਰੁਖ ਖਾਨ ਪ੍ਰਿਅੰਕਾ ਚੋਪੜਾ ਦੀਪਿਕਾ ਪਾਦੁਕੋਣ ਆਲੀਆ ਭੱਟ ਰਣਵੀਰ ਕਪੂਰ ਰਣਵੀਰ ਸਿੰਘ